ਹਾਂਜੀ ਕਰੋਨਾ ਵੇਲੇ ਨਾ ਆਪਣੇ ਨਾ ਆਨਲਾਈਨ ਕਲਾਸਾਂ ਲੱਗਦੀਆਂ ਸੀਗੀਆਂ ਮੇਰੇ ਪੋਤੇ ਪੋਤੀਆਂ ਘਰ ਸੀ ਉਹ ਵੀ ਮੈਨੂੰ ਦਾਦਾ ਸਾਨੂੰ ਕੰਪ ਲੈਪਟਾਪ ਲੈ ਕੇ ਦੇ ਲੈਪਟਾਪ ਲੈ ਕੇ ਦੇ ਤਾਂ ਮੈਂ ਉਹਨਾਂ ਨੂੰ ਡੈਲ ਕੰਪਨੀ ਦਾ ਲੈਪਟਾਪ ਲੈ ਕੇ ਦੇ ਦਿੱਤਾ ਜੀ ਉਹ ਆਪਣਾ ਚਾਰ ਪੰਜ ਦਿਨ ਤਾਂ ਵਧੀਆ ਚੱਲਿਆ ਜੀ ਫਿਰ ਤਾਂ ਉਹਨੂੰ ਪਤਾ ਨਹੀਂ ਕੀ ਉਹਨੂੰ ਬਿਮਾਰੀ ਪਈ ਪਤੰਦਰ ਚੱਲਿਆ ਨਹੀਂ ਦੋ ਮਿੰਟ ਚੱਲ ਜਾਇਆ ਕਰੇ ਫਿਰ ਉਹ ਬੰਦ ਹੋ ਜਾਇਆ ਕਰੇ ਹਮੇਸ਼ਾ ਰੋਜ਼ ਚੱਲਦਾ ਨਾ ਤਾਂ ਉਹਦੀ ਕੋਈ ਵੀਡੀਓ ਹੈਗੀ ਨਾ ਹੀ ਕੋਈ ਹੋਰ ਉਹਦੀ ਆਵਾਜ਼ ਅਵੂਜ ਬੱਚਿਆਂ ਨੂੰ ਅਸੀਂ ਤਾਂ ਇੰਨੇ ਜ਼ਿਆਦਾ ਪਰੇਸ਼ਾਨ ਕੀਤੇ ਪਏ ਨੇ ਇਸ ਲੈਪਟੋਪ ਨੇ ਵੀ ਦੱਸ ਹੀ ਨਹੀਂ ਸਕਦੇ ਹੈਗੇ ਹਾਂਜੀ ਇਹ ਬਸ ਉਦੋਂ ਹੀ ਤਾਂ ਲਿਆ ਤੁਹਾਡੇ ਕੋਲੋਂ ਹੀ ਲਿਆ ਸੀ ਇਸ ਦੁਕਾਨ ਤੋਂ ਹੀ ਲਿਆ ਸੀਗਾ ਆਪਾਂ ਅਤੇ ਪਰ ਇਹ ਕੋਈ ਜ਼ਿਆਦਾ ਵਧੀਆ ਨਹੀਂ ਇਹਨੇ ਤਸੱਲੀ ਬਖਸ਼ ਇਹਨੇ ਸਾਨੂੰ ਖੁਸ਼ ਕੀਤਾ ਗਾ ਕਿਉਂਕਿ ਡੇਲੀ ਦਾ ਹੀ ਖਰਾਬ ਆ ਕਿ ਇੱਕ ਦੋ ਵਾਰ ਤੁਹਾਡੇ ਕੋਲ ਵੀ ਆ ਗਏ ਤੁਸੀਂ ਵੀ ਐਂ ਲੱਲਾ ਭੱਬਾ ਕਰਕੇ ਵਾਪਿਸ ਕਰ ਦਿੰਦੇ ਹੋਗੇ ਤੇ ਜਾਂ ਤਾਂ ਤੁਸੀਂ ਇਹਦਾ ਕੋਈ ਪੱਕਾ ਹੱਲ ਕਰ ਦਿਓ ਹੈ ਨਾ ਵੀ ਮੇਰਾ ਸਾਡਾ ਤਾਂ ਇਹਨੇ ਇਨ ਤੀਹ ਹਜ਼ਾਰ ਰੁਪਈਆ ਲੱਗਿਆ ਉਦੋਂ ਖੜੇ ਪੈਰ ਵੀ ਇਹ ਚਲੋ ਵੀ ਜਵਾਕਾਂ ਦੀ ਪੜ੍ਹਾਈ ਨਾ ਖਰਾਬ ਹੋਵੇ ਚੱਲਦਾ ਇਹ ਫਿਰ ਵੀ ਨੀਗਾ ਨਾਲੇ ਵਧੀਆ ਕੰਪਨੀ ਦੇ ਡੈਲ ਕੰਪਨੀ ਤਾਂ ਪੂਰੀ ਮੰਨੀ ਪਰਮੰਨੀ ਕੰਪਨੀ ਹੈ ਫਿਰ ਵੀ ਨਹੀਂ ਇਹ ਵਧੀਆ ਵਰਕ ਕਰ ਰਿਹਾ ਕਿਰਪਾ ਕਰਕੇ ਜਾਂ ਤਾਂ ਇਹਨੂੰ ਐਕਸਚੇਂਜ ਕਰੋ ਜਾਂ ਕੰਪਨੀ ਨਾਲ ਗੱਲ ਕਰੋ ਹੈ ਨਾ ਕਿਵੇਂ ਵੀ ਕਰੋ ਸਾਡੇ ਇਹਦਾ ਜਿਹੜਾ ਐਕਸਪੀਰੀਅਂਸ ਆ ਨਾ ਮੈਨੂੰ ਵਧੀਆ ਨਹੀਂ ਲੱਗਿਆ ਵੀ ਜਮਾਂ ਜੀ ਦੱਸੋ ਜੀ ਹੁਣ ਮੈਂ ਕੀ ਕਹਾਂ ਇਹਦੇ ਬਾਰੇ

ਚਲੋ ਵੀ ਆਪਾਂ ਇੰਨੇ ਪੈਸੇ ਵੀ ਲਗਾਏ ਆ ਚੱਜ ਨਾਲ ਕੰਮ ਕਰਦਾ ਜਵਾਕ ਸਾਡੇ ਦੋ ਚਾਰ ਦਿਨ ਕਲਾਸਾਂ ਲਗਾਉਂਦੇ ਤਾਂ ਪੈਸੇ ਦਿੱਤਿਆ ਦਾ ਵੀ ਮੁੱਲ ਮੁੜ ਜਾਂਦਾ ਹੈਨਾ ਤਾਂ ਬਿਲਕੁਲ ਨਹੀਂ ਵਧੀਆ ਜੀ ਇੰਨਾ ਤਾਂ ਜ਼ਿਆਦਾ ਹੈਂਗ ਹੁੰਦਾ ਹੈਗਾ ਇਹ ਅਤੇ ਚੱਲਿਆ ਤਾਂ ਹੈ ਹੀ ਨਹੀਂ ਦਸ ਮਿੰਟ ਤੋਂ ਵੱਧ ਕਦੇ ਸਾਰਾ ਦਿਨ ਉਹ ਕੋਈ ਬੈਟਰੀ ਇਹਦੀ ਡਾਊਨ ਹੋਈ ਰਹਿੰਦੀ ਆ ਸਾਰਾ ਦਿਨ ਚਾਰਜ ਜਿਹਾ ਲਗਾ ਕੇ ਹੀ ਉਹ ਕਲਾਸਾਂ ਲਗਾਈਆਂ ਜਵਾਕਾਂ ਨੇ ਬੁਰੇ ਹਾਲ ਬੱਸ ਠੀਕ ਹੈ ਜੀ ਬਸ ਮੇਰੀ ਤਾਂ ਇਹ ਬੇਨਤੀ ਹੈ ਜੀ ਇਹਨੂੰ ਪਲੀਜ਼ ਹੈ ਨਹੀਂ ਇਹਦਾ ਕੋਈ ਵਧੀਆ ਐਕਸਪੀਰੀਅਂਸ ਨਹੀਂ ਅਸੀਂ ਇਹਨੂੰ ਕਹਿ ਸਕਦੇ ਸਾਡਾ ਤਾਂ ਹੱਥ ਖੜੇ ਕਰਾ ਦਿੱਤੇ ਤੁਹਾਡੇ ਇਸ ਲੈਪਟੋਪ ਨੇ ਠੀਕ ਹੈ ਜੀ ਓਕੇ ਜੀ